ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਅੱਛਾ ਜੀ ਇਹ ਨਾ ਐਂ ਸੀਗਾ ਜੀ ਐਤਕੀ ਗਰਮੀ ਕਰਕੇ ਮੱਚੀ ਬਹੁਤ ਜਾਂਦੇ ਆ ਹਰੀਆਂ ਹੀ ਹੋ ਰਹੀਆਂ ਅੱਧੀਆਂ ਹਰੀਆਂ ਹੁੰਦੀਆਂ ਨੇ ਅਤੇ ਹਾਂ ਅਤੇ ਥੋੜ੍ਹੀ ਜਿਹੀ ਇੱਕ ਤਾਂ ਲੇਟ ਬੀਜਿਓ ਪਨੀਰੀ ਇੱਕ ਐਂ ਕਰਿਓ ਇਹਨੂੰ ਸੁੱਕੀ ਸੁੱਟਿਓ ਭਿਉਂਓ ਨਾ ਪਹਿਲਾਂ ਅਤੇ ਹਾਂ ਸੁੱਕੀ ਸੁੱਟਣ ਨਾਲ ਐਂ ਜਿਹੜੇ ਤਾਂ ਆਪਾਂ ਭਿਉਂ ਲੈਂਦੇ ਉਹਦੇ ਢੰਗੂਰ ਚੱਕ ਆਉਂਦੀ ਆ ਉਹ ਗਰਮੀ ਕਰਕੇ ਫਿਰ ਢੰਗੂਰ ਮੱਚ ਜਾਂਦੇ ਨੇ ਹਾਂ ਅਤੇ ਜਦੋਂ ਇੱਕ ਇਹਨੂੰ ਬੀਜੋਗੇ ਉਦੋਂ ਬੀਜਿਓ ਆਥਣੇ ਠੰਡੇ ਹੋਏ ਪਾਣੀ ਕੁਛ ਤਾਂ ਇਹਨੂੰ ਥੱਲੇ ਰਲਾ ਦਿਉ ਜੀ ਪਹਿਲਾਂ ਹਾਂ ਹਾਂ ਪਹਿਲਾਂ ਸੁੱਟ ਕੇ ਵੀ ਥੱਲੇ ਜਿਵੇਂ ਆਪਣੀ ਆਹ ਹੋ ਗਈ ਪੌਟਾਸ਼ ਹੋ ਗਈ ਜਿੰਕ ਹੋ ਗਈ ਅਤੇ ਆਪਣੀ ਸੁਪਰ ਹੋ ਗਈ ਇਹ ਥੱਲੇ ਪਹਿਲਾਂ ਮਿੱਟੀ 'ਚ ਰਲਾ ਦਿਓ ਓਦੂੰ ਬਾਅਦ ਬੀਜ ਸੁੱਟ ਕੇ ਤਬਰ ਰੋਲ ਨਾ ਮਾਰ ਦਿਓ ਹਾਂ ਉਹਦੇ ਨਾਲ ਉਹ ਨਾਲ ਬੀਜ ਰਲ ਜੂਗਾ ਜੀ

ਰੂੜੀ ਦੀ ਖਾਦ ਐਂ ਆ ਜੀ ਜੇ ਪੁਰਾਣੀ ਪਈ ਆ ਤੁਹਾਡੇ ਕੋਲ ਤਾਂ ਉਹ ਪਾ ਸਕਦੇ ਹੋ ਹਾਂਜੀ ਹਾਂ ਹਾਂਜੀ ਇੱਕ ਆਪਾਂ ਉਹ ਵੀ ਗੱਲ ਕਰੀਏ ਵੀ ਇਹ ਨਾ ਜਿਹੜੇ ਪੈਸਟੀਸਾਈਡ ਨੇ ਜ਼ਿਆਦੇ ਇਹਦੇ ਨਾਲ ਵੀ ਬਹੁਤ ਨੁਕਸਾਨ ਹੁੰਦਾ ਹਾਂ ਜਿਵੇਂ ਆਪਾਂ ਗੱਲ ਕਰੀਏ ਵੀ ਗ੍ਰੀਨ ਜਿਹੜਾ ਪਹਿਲੀ ਸੀ ਆਮ ਲੋਕ ਪਹਿਲਾਂ ਰੇਹਾਂ ਸਪਰੇਹਾਂ ਨਹੀਂ ਪਾਉਂਦੇ ਸੀਗੇ ਫਸਲ ਨੂੰ ਕੋਈ ਦਿੱਕਤ ਨਹੀਂ ਪੈਂਦੀ ਸੀਗੀ ਆਪਣੇ ਆਪ ਹੀ ਬੀਜ ਹਰੇ ਹੋ ਜਾਂਦੇ ਨਾਲੇ ਖਰਚਾ ਘੱਟ ਆਉਂਦਾ ਸੀਗਾ ਹੁਣ ਜਿੱਦਣ ਦੀ ਆਹ ਹਰੀ ਕ੍ਰਾਂਤੀ ਆਈ ਹੈ ਤਾਂ ਲੋਕ ਰੇਹਾਂ ਸਪਰੇਹਾਂ ਬਹੁਤ ਵਰਤਣ ਲੱਗ ਗਏ ਹਾਂ ਅਤੇ ਕੀ ਹੋਇਆ ਇਹਦੇ ਨਾਲ ਹੈਂਜੀ ਹਾਂਜੀ ਹਾਂ ਆਪਾਂ ਚ ਚੱਕਰ 'ਚ ਪੈ ਗਏ ਵੀ ਆਪਣੀ ਫਸਲ ਦਾ ਝਾੜ ਵੱਧ ਆਵੇ ਹਾਂਜੀ ਹਾਂ ਹਾਂਜੀ ਹਾਂ ਝਾੜ ਤਾਂ ਵੱਧ ਗਏ ਪਰ ਆਹ ਨੁਕਸਾਨ ਜ਼ਿਆਦਾ ਹੋਣ ਲੱਗ ਗਏ ਹਾਂ ਬਿਮਾਰੀਆਂ ਵੀ ਬਹੁਤ ਲੱਗਣ ਲੱਗ ਗਈਆਂ ਹਾਂ ਰੇਹ ਸਪਰੇਹ ਬਾਹਲੀ ਪਾਉਂਦੇ ਨੇ ਜੀ ਤਿੰਨ ਤਿੰਨ ਚਾਰ ਚਾਰ ਬੋਰੀਆਂ ਪਾਈ ਜਾਂਦੇ ਨੇ ਹਾਂ ਜਦੋਂ ਪਹਿਲਾਂ ਤੁਸੀਂ ਖੇਤੀ ਕਰਦੇ ਸੀ ਕਿਹੜੀ ਪਾਉਂਦੇ ਸੀ ਰੇਹ ਸਪਰੇ ਹਾਂਜੀ ਹਾਂ ਅਤੇ ਨਾਲੇ ਸਵਾਦ ਲੱਗਦਾ ਸੀ ਅੰਨ ਪਾਣੀ ਹਾਂਜੀ ਹਾਂ ਅਤੇ ਉਦੋਂ ਤੇਜ਼ਾਬ ਤਾਂ ਬਣਦਾ ਨਹੀਂ ਹੋਣਾ ਕਿਸੇ ਦਾ ਸੁਣਿਆ ਨਹੀਂ ਹੋਣਾ ਕਦੇ ਹਾਂਜੀ ਹਾਂ

ਚੰਗਾ ਜੀ ਫੇਰ ਸਤਿ ਸ਼੍ਰੀ ਅਕਾਲ ਜੀ